ਪੰਜਾਬ ਵਿੱਚ ਵਪਾਰਕ ਖੇਤਰ ਵਿੱਚ ਚੁਣੌਤੀਆਂ ਜ਼ਿਆਦਾਤਰ ਚੁਣੌਤੀਆਂ ਰੁਕਾਵਟਾਂ ਜ਼ਿਆਦਾਤਰ ਗਰੀਬ ਬੰਦੇ ਜਾਂ ਕਿਸਾਨ ਨੂੰ ਹੀ ਆਉਂਦੀਆਂ ਹਨ ਕਿਉਂਕਿ ਇਹ ਇਹ ਦੇਖਿਆ ਜਾਂਦਾ ਹੈ ਕਿ ਹੁਣ ਜਿਵੇਂ ਪਿੱਛੇ ਜਿਹੇ ਨੂੰ ਜ਼ਿਆਦਾ ਮੀਂਹ ਜ਼ਿਆਦਾ ਬਾਰਿਸ਼ ਪੈਣ ਕਰਕੇ ਹੜ੍ਹ ਆ ਗਏ ਸੀ ਲਗਭਗ ਅਤੇ ਉਹਦੇ ਨਾਲ ਕਿਆ ਹੋਇਆ ਲੋਕਾਂ ਦੇ ਜਿਹੜੇ ਕਿਸਾਨ ਵਿਚਾਰਿਆਂ ਦੇ ਖੇਤਾਂ ਵਿੱਚ ਐਨਾ ਪਾਣੀ ਖੜ੍ਹ ਗਿਆ ਕਿ ਹਫ਼ਤਾ ਮੀਂਹ ਪੈਂਦਾ ਰਿਹਾ ਸਾਰੀ ਫ਼ਸਲ ਬਰਬਾਦ ਹੋ ਗਈ ਅਤੇ ਜਿਨ੍ਹਾਂ ਦੇ ਮਾੜਾ ਮੋਟਾ ਵੀ ਕਿਆ ਕਹਿੰਦੇ ਹੈ ਫ਼ਸਲ ਮਾੜੀ ਮੋਟੀ ਬਚੀ ਸੀ ਉਹ ਵੀ ਸਰਕਾਰੀ ਰੇਟਾਂ 'ਤੇ ਨਿਕਲੀ ਜਦ ਕਿ ਉਹਦਾ ਪੂਰਾ ਮੁਆਵਜ਼ਾ ਨਹੀਂ ਮਿਲ ਸਕਿਆ ਅਤੇ ਉਸ ਤੋਂ ਬਾਅਦ ਦੂਜੀ ਗੱਲ ਕਰਾਂ ਜਿਹੜੇ ਆਮ ਆਦਮੀ ਹੈ ਹੁਣ ਜਿਵੇਂ ਕਿ ਟਮਾਟਰ ਦੀ ਗੱਲ ਕਰਾਂ ਤਾਂ ਇਸ ਟਾਈਮ ਟਮਾਟਰ ਦਾ ਰੇਟ ਦੋ ਸੌ ਰੁਪਏ ਕਿਲੋ ਚਲਾ ਗਿਆ ਹੈ ਅਮੀਰ ਬੰਦੇ ਲਈ ਤਾਂ ਚਲ ਕੋਈ ਜ਼ਿਆਦਾ ਬੜੀ ਗੱਲ ਨਹੀਂ ਹੈ ਪਰ ਜਿਹੜਾ ਗ਼ਰੀਬ ਆਦਮੀ ਅੱਜ ਕੱਲ੍ਹ ਆਪਣੇ ਘਰ ਦੀ ਸਬਜ਼ੀ ਬਿਨਾਂ ਟਮਾਟਰ ਤੋਂ ਬਣਾ ਰਿਹਾ ਹੈ ਅਤੇ ਕਿ ਕਿਉਂਕਿ ਇਹ ਮਹਿੰਗਾ ਹੀ ਐਨਾ ਹੋ ਚੁੱਕਿਆ ਹੈ ਜਿੱਥੋਂ ਆ ਰਿਹਾ ਸਭ ਮਹਿੰਗਾ ਮਿਲ ਰਿਹਾ ਹੈ ਸਭ ਤੋਂ ਜ਼ਿਆਦਾ ਨੁਕਸਾਨ ਕਿਸਾਨ ਦਾ ਹੋਇਆ ਹੈ